ਇਸ ਖੇਤਰ ਵਿੱਚ ਸਮੇਂ ਦੇ ਨਾਲ਼ ਧਰਮ ਵਿੱਚ ਬਹੁਤ ਵਿਕਾਸ ਹੋਇਆ ਹੈ ਸਿੱਖ ਧਰਮ ਪਹਿਲਾਂ ਨਾਲ਼ੋਂ ਜ਼ਿਆਦਾ ਵਿਕਸਿਤ ਹੋ ਗਿਆ ਹੈ ਇਸ ਦਾ ਕਾਰਨ ਇਸ ਵਿੱਚ ਫਲੈਕਸੀਬਿਲਟੀ ਹੈ ਸਿੱਖ ਧਰਮ ਇੱਕ ਧਰਮ ਨਿਰਪੱਖ ਵੀ ਹੈ ਇਸ ਵਿੱਚ ਕਾਫ਼ੀ ਵਿਕਾਸ ਹੋਇਆ ਹੈ ਕਿਉਂ ਇਸ ਇਸ ਸਥਾਨ 'ਤੇ ਬਹੁਤ ਸਾਰੇ ਧਾਰਮਿਕ ਸਥਾਨ ਧਾਰਮਿਕ ਧਾਰਮਿਕ ਗੁਰਦੁਆਰੇ ਪਾਏ ਜਾਂਦੇ ਹਨ ਜਿਸ ਕਾਰਨ ਇਸ ਵਿੱਚ ਬਹੁਤ ਸਾਰਾ ਵਿਕਾਸ ਹੋਇਆ ਹੈ ਇਹ ਸਾਨੂੰ ਇਹ ਸਾਨੂੰ ਕੱਟੜਪੁਣੇ ਤੋਂ ਬਾਹਰ ਵੀ ਕੱਢਦਾ ਹੈ ਇਹ ਸਾਨੂੰ ਕੱਟੜਪੁਣੇ ਤੋਂ ਬਹੁਤ ਜ਼ਿਆਦਾ ਦੂਰ ਰੱਖਦਾ ਹੈ